ਜਿਵੇਂ ਕਿ ਪਿੰਡਾਂ ਵਿੱਚ ਮੁੱਢ ਤੋਂ ਹੀ ਖੇਡਾਂ ਖੇਡੀਆਂ ਜਾਂਦੀਆਂ ਹਨ ਖੇਡਾਂ ਪਿੰਡਾਂ ਦੇ ਲੋਕਾਂ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਬਣਾਉਂਦੀਆਂ ਹਨ ਖੇਡਾਂ ਖੇਡਣ ਨਾਲ ਪੇਂਡੂ ਖੇਤਰ ਦੇ ਲੋਕ ਸਰੀਰਕ ਤੌਰ 'ਤੇ ਮਜਬੂਤ ਹੁੰਦੇ ਹਨ ਇਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੇ ਲੋਕਾਂ ਦੇ ਮੁਕਾਬਲੇ ਬਿਮਾਰੀਆਂ ਘੱਟ ਹੁੰਦੀਆਂ ਹਨ ਅਤੇ ਪਿੰਡਾਂ ਦੇ ਲੋਕ ਘੱਟ ਬਿਮਾਰ ਹੁੰਦੇ ਹਨ ਪਿੰਡਾਂ ਦੇ ਲੋਕ ਸ਼ਹਿਰੀਆਂ ਦੇ ਮੁਕਾਬਲੇ ਜ਼ਿਆਦਾ ਤਾਕਤਵਰ ਹੁੰਦੇ ਹਨ ਖੇਡਾਂ ਖੇਡਣ ਕਰਕੇ ਪਿੰਡਾਂ ਦੇ ਲੋਕਾਂ ਦਾ ਮਾਨਸਿਕ ਤੌਰ 'ਤੇ ਵੀ ਮਾਨਸਿਕ ਤੌਰ 'ਤੇ ਵੀ ਕਾਫ਼ੀ ਵਿਕਾਸ ਹੁੰਦਾ ਹੈ ਅਤੇ ਸਰੀਰਕ ਤੌਰ 'ਤੇ ਵੀ ਉਹ ਤੰਦਰੁਸਤ ਹੁੰਦੇ ਹਨ ਖੇਡਾਂ ਖੇਡਣ ਨਾਲ ਪਿੰਡਾਂ ਦੇ ਲੋਕ ਜ਼ਿਆਦਾ ਸਕਾਰਾਤਮਕ ਮਹਿਸੂਸ ਕਰਦੇ ਹਨ ਤਾਂ ਹੀ ਪਿੰਡਾਂ ਦੇ ਲੋਕਾਂ ਨੂੰ ਡਿਪਰੈਸ਼ਨ ਟੈਂਸ਼ਨ ਇਨਜਾਇਟੀ ਵਰਗੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ ਇਸ ਦੇ ਨਾਲ ਨਾਲ ਹੀ ਉਹਨਾਂ ਦੀ ਜਾਜ ਯਾਦਾਸ਼ਤ ਸ਼ਕਤੀ ਵੀ ਤੇਜ਼ ਹੰਦੀ ਹੈ ਅਤੇ ਖੇਡਾਂ ਖੇਡਣ ਨਾਲ ਆਪਸੀ ਭਾਈਚਾਰਾ ਵੀ ਵੱਧਦਾ ਹੈ ਆਪਸੀ ਭਾਈਚਾਰਾ ਵੱਧਣ ਨਾਲ ਉਹਨਾਂ ਨੂੰ ਲੋਕਾਂ ਨਾਲ ਗਤ ਗੱਲਬਾਤ ਕਰਨ ਦਾ ਢੰਗ ਆਉਂਦਾ ਹੈ ਜਿਵੇਂ ਕਿ ਹਰ ਇੱਕ ਇਨਸਾਨ ਦਾ ਵੱਖਰਾ ਵੱਖਰਾ ਸੁਭਾਅ ਹੁੰਦਾ ਹੈ ਉਹਨਾਂ ਦੇ ਸੁਭਾਅ ਨਾਲ ਕਿੰਝ ਨਜਿੱਠਣਾ ਹੈ ਖੇਡਾਂ ਨਾਲ ਸਿਰਫ਼ ਬਾਕੀ ਲੋਕਾਂ ਨਾਲ ਹੀ ਨਹੀਂ ਟੀਮ ਦੇ ਸਾਥੀਆਂ ਨਾਲ ਵੀ ਗੱਲਬਾਤ ਕਰਨ ਦਾ ਢੰਗ ਆਉਂਦਾ ਹੈ ਅਤੇ ਖੇਡਾਂ ਖੇਡਣ ਨਾਲ ਮੋਟੀਵੇਸ਼ਨ ਵੀ ਮਿਲਦੀ ਹੈ ਸ਼ਹਿਰਾਂ ਵਿੱਚ ਜਗ੍ਹਾ ਘੱਟ ਹੋਣ ਕਰਕੇ ਖੇਡ ਨਹੀਂ ਸਕਦੇ ਪਰ ਪਿੰਡਾਂ ਵਿੱਚ ਜਗ੍ਹਾ ਜ਼ਿਆਦਾ ਹੋਣ ਕਰਕੇ ਲੋਕ ਭੱਜ ਦੌੜ ਜ਼ਿਆਦਾ ਕਰਦੇ ਹਨ ਜਿਨ੍ਹਾਂ ਨਾਲ ਉਹਨਾਂ ਦਾ ਸਰੀਰਕ ਵਿਕਾਸ ਹੁੰਦਾ ਹੈ ਧੰਨਵਾਦ